ਮੈਂ ਦੀਕਸ਼ਾ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਪੰਜਾਬੀ ਭਾਸ਼ਾ ਦਾ ਕੀ ਇਤਿਹਾਸ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਇਹ ਭਾਸ਼ਾ ਸਾਡੇ ਗੁਰੂਆਂ ਦੀ ਦੇਣ ਹੈ ਪੰਜਾਬੀ ਭਾਸ਼ਾ ਗੁਰਮੁਖੀ ਤੋਂ ਸ਼ੁਰੂ ਹੋਈ ਗੁਰਮੁਖੀ ਤੋਂ ਸਾਨੂੰ ਕੁਝ ਅੱਖਰ ਮਿਲੇ ਪੰਜਾਬੀ ਦੇ ਜਿਹਦੇ ਤੋਂ ਪੰਜਾਬੀ ਭਾਸ਼ਾ ਸ਼ੁਰੂ ਹੋਈ ਸੀ ਅਤੇ ਸਾਡੇ ਪੰਜਾਬ ਦੀ ਮਾਂ ਬੋਲੀ ਵੀ ਪੰਜਾਬੀ ਹੀ ਹੈ ਪੰਜਾਬੀ ਮਾਂ ਬੋਲੀ ਇਸ ਕਰਕੇ ਕਿਹਾ ਜਾ ਸਕਦਾ ਹੈ ਕਿਉਂਕਿ ਬੱਚਾ ਜੋ ਬੋਲ ਆਪਣੀ ਮਾਂ ਦੇ ਮੂੰਹ ਤੋਂ ਸੁਣਦਾ ਹੈ ਉਹ ਬੋਲੀ ਹੀ ਉਸ ਦੀ ਮਾਂ ਬੋਲੀ ਹੁੰਦੀ ਹੈ ਤਾਂ ਸਾਡੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਇਸ ਕਰਕੇ ਪੰਜਾਬ ਦੀ ਬੋਲੀ ਮਾਂ ਬੋਲੀ ਪੰਜਾਬੀ ਹੀ ਹੈ ਅਤੇ ਪੰਜਾਬੀ ਭਾਸ਼ਾ ਪੰਜਾਬ ਵਿੱਚ ਇੰਨੀ ਜ਼ਿਆਦਾ ਵਿਕਸਿਤ ਹੋ ਗਈ ਕਿ ਸਰਕਾਰੀ ਦਫ਼ਤਰਾਂ ਦੇ ਜਿੰਨੇ ਵੀ ਕੰਮ ਹਨ ਕਾਗਜ਼ਾਂ ਦੇ ਉਹ ਸਾਰੇ ਪੰਜਾਬੀ ਭਾਸ਼ਾ ਵਿੱਚ ਹੀ ਹੋਣ ਲੱਗ ਪਏ ਅਤੇ ਪੰਜਾਬੀ ਭਾਸ਼ਾ ਹੀ ਸਕੂਲਾਂ ਵਿੱਚ ਵੀ ਵਿਖਿਆਤ ਹੋ ਗਈ ਸਕੂਲਾਂ ਵਿੱਚ ਬੱਚਿਆਂ ਨੂੰ ਪਹਿਲੀ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਹੀ ਸਿਖਾਈ ਜਾਂਦੀ ਹੈ ਅਤੇ ਬੱਚਿਆਂ ਦੇ ਜ਼ਿਆਦਾਤਰ ਸਬਜੈਕਟ ਜੋ ਹੁੰਦੇ ਹਨ ਉਹ ਪੰਜਾਬੀ ਭਾਸ਼ਾ ਵਿੱਚ ਹੀ ਹੁੰਦੇ ਹਨ ਪਰ ਕੁਝ ਬੱਚੇ ਇੰਗਲਿਸ਼ ਮੀਡੀਅਮ ਵੀ ਪਰ ਪੜ੍ਹਦੇ ਹਨ ਪਰ ਜਿਹੜੀ ਪੰਜਾਬ ਦੀ ਬੋਲੀ ਹੈ ਉਹ ਪੰਜਾਬੀ ਹੀ ਹੈ ਅਤੇ ਅੰਦਾਜ਼ੇ ਅਨੁਸਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਉਹ ਤਕਰੀਬਨ ਪੈਂਤੀ ਸੌ ਸਾਲ ਪੁਰਾਣੀ ਭਾਸ਼ਾ ਹੈ ਅਤੇ ਇਹ ਹਜੇ ਵੀ ਬੋਲੀ ਜਾਂਦੀ ਹੈ ਧੰਨਵਾਦ